ਬਾਈ ਮਈ ਉੱਨੀ ਸੌ ਅੱਸੀ ਇੱਕ ਜਨਵਰੀ ਦੋ ਹਜ਼ਾਰ ਦੋ ਦਸ ਜੂਨ ਦੋ ਹਜ਼ਾਰ ਅਠਾਰ੍ਹਾਂ ਪੰਦਰ੍ਹਾਂ ਅਪ੍ਰੈਲ ਦੋ ਹਜ਼ਾਰ ਵੀਹ ਉੱਨੀ ਅਗਸਤ ਦੋ ਹਜ਼ਾਰ ਬਾਰ੍ਹਾਂ